ਇੱਕ ਕਲਾਕਾਰ ਦੇ ਰੂਪ ਦੇ ਵਿੱਚ ਮੈਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਜਦੋਂ ਮੈਂ ਸਕੂਲ ਵਿੱਚ ਪੜ੍ਹਦੀ ਸੀ ਤਾਂ ਸਾਡੇ ਟੀਚਰ ਨਹੀਂ ਸੀ ਪੂਰੇ ਹੁੰਦੇ ਅਤੇ ਜੇਕਰ ਟੀਚਰ ਹੁੰਦਾ ਸੀ ਤਾਂ ਉਹਨੂੰ ਇੰਨਾ ਜ਼ਿਆਦਾ ਪਤਾ ਨਹੀਂ ਸੀ ਪੇਂਟਿੰਗ ਬਾਰੇ ਜਿਸ ਕਰਕੇ ਸਾਨੂੰ ਪੂਰੀ ਤਰ੍ਹਾਂ ਸਮਝਾ ਨਹੀਂ ਸੀ ਪਾਉਂਦਾ ਅਤੇ ਜੋ ਅਸੀਂ ਗਲਤੀਆਂ ਕਰਦੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਅਸੀਂ ਗਲਤੀ ਕਰ ਰਹੇ ਹਾਂ ਜਿਸ ਕਰਕੇ ਸਾਨੂੰ ਬਹੁਤ ਸਾਰੇ ਸਾਰੀਆਂ ਮੁਸ਼ਕਿਲਾਂ ਹੁੰਦੀਆਂ ਸੀ ਅਤੇ ਜੇਕਰ ਆਪਾਂ ਪਿੰ ਇੱਥੋਂ ਦੇ ਮਾਹੌਲ ਦੇ ਹਿਸਾਬ ਨਾਲ ਦੇਖੀਏ ਤਾਂ ਸਾਡੇ ਪਿੰਡ ਵਿੱਚ ਸਾਡਾ ਪਿੰਡ ਜਿਹੜਾ ਹੈ ਬੈਕਵਰਡ ਆ ਜਿਹਦੇ ਕਰਕੇ ਇੱਥੋਂ ਦਾ ਸਮਾਨ ਜਿਹੜਾ ਪੇਂਟਿੰਗ ਦਾ ਉਹ ਬਿਲਕੁਲ ਨਹੀਂ ਸੀ ਮਿਲਦਾ ਜੇਕਰ ਮਿਲਦਾ ਵੀ ਸੀ ਤਾਂ ਉਹ ਖਰਾਬ ਮਿਲਦਾ ਸੀ ਅਤੇ ਇੱਕ ਜਾਂ ਦੋ ਵਾਰ ਯੂਜ ਕਰਨ ਤੋਂ ਬਾਅਦ 'ਚੋਂ ਉਹ ਖਰਾਬ ਹੋ ਜਾਂਦਾ ਸੀ ਉਹ ਟੁੱਟ ਜਾਂਦਾ ਸੀਗਾ ਅਤੇ ਅਜਿਹੇ ਕਲਰ ਮਿਲਦੇ ਸੀ ਤਾਂ ਉਹ ਕੱਚੇ ਮਿਲਦੇ ਸੀ ਅਤੇ ਪੱਕੇ ਕਲਰ ਨਹੀਂ ਸੀ ਮਿਲਦੇ ਜਿਨ੍ਹਾਂ ਕਰਕੇ ਸਾਡੀ ਪੇਂਟਿੰਗ ਇੰਨੀ ਵਧੀਆ ਨਹੀਂ ਸੀ ਬਣ ਪਾਉਂਦੀ ਅਤੇ ਸਾਨੂੰ ਇਹ ਸਾਰਾ ਸਮਾਨ ਖਰੀਦਣ ਲਈ ਸ਼ਹਿਰ ਜਾਣਾ ਪੈਂਦਾ ਸੀ ਅਤੇ ਇਹ ਸਾਰੀਆਂ ਚੀਜ਼ਾਂ ਸੀ ਜਿਨ੍ਹਾਂ ਦਾ ਮੈਂ ਅਨੁਭਵ ਕੀਤਾ ਹੈ